ਤਰਨਤਾਰਨ ਜ਼ਿਲ੍ਹੇ ਵਿੱਚ ਬਹੁਤ ਹੀ ਮਹੱਤਵਪੂਰਨ ਅਤੇ ਇਤਿਹਾਸਿਕ ਸਥਾਨ ਹਨ ਜਿਵੇਂ ਕਿ ਬਹੁਤ ਸਾਰੇ ਗੁਰਦੁਆਰੇ ਮੰਦਿਰ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਕੁਦਰਤੀ ਵਿਸ਼ੇਸ਼ਤਾਵਾਂ ਅਜਾਇਬ ਘਰ ਕਿਲੇ ਬਹੁਤ ਸਾਰੇ ਸਥਾਨ ਹਨ ਜਿੱਥੇ ਕਿ ਅਸੀਂ ਜਾ ਸਕ ਜਾਂ ਜਾ ਸਕਦੇ ਹਾਂ ਜਿਵੇਂ ਕਿ ਗੁਰਦੁਆਰਾ ਦਰਬਾਰ ਸਾਹਿਬ ਮਦਨ ਮੋਹਨ ਮੰਦਿਰ ਥੋਮਸ ਚਰਚ ਬਾਬਾ ਬੁੱਢਾ ਸਾਹਿਬ ਜੋ ਕਿ ਤਰਨ ਤਾਰਨ ਸਾਹਿਬ ਤੋਂ ਥੋੜ੍ਹੀ ਜਿਹੀ ਦੂਰੀ 'ਤੇ ਹੈ ਲੋਕ ਆਪਣੀ ਮਰਜੀ ਅਨੁਸਾਰ ਬਿਨਾਂ ਕਿਸੇ ਦੀ ਰੋਕ ਟੋਕ ਤੋਂ ਕਿ ਕਦੀ ਵੀ ਕਿਤੇ ਵੀ ਜਾ ਸਕਦੇ ਨੇ ਇੱਥੇ ਬਹੁਤ ਸਾਰੇ ਅਜਾਇਬ ਘਰ ਹਨ ਗੁਰਦੁਆਰਾ ਸਾਹਿਬ ਵਿੱਚ ਅਜਾਇਬ ਘਰ ਵੀ ਹੈ ਜਿੱਥੇ ਕਿ ਪੂਰਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਦਰਜ ਕੀਤਾ ਹੋਇਆ ਹੈ ਕਿ ਗੁਰੂ ਸਾਹਿਬਾਨ ਨੇ ਕਿਵੇਂ ਕਿਵੇਂ ਸ਼ਹੀਦੀ ਪ੍ਰਾਪਤ ਕੀਤੀ ਕਿਵੇਂ ਉਹਨਾਂ ਦਾ ਜਨਮ ਹੋਇਆ ਕਿਵੇਂ ਉਹਨਾਂ ਨੇ ਆਪਣਾ ਸਾਰਾ ਜੀਵਨ ਬਤੀਤ ਕੀਤਾ ਗੁਰਦੁਆਰੇ ਦਾ ਪੂਰਾ ਇਤਿਹਾਸ ਉਸ ਅਜਾਇਬ ਘਰ ਵਿੱਚ ਦਰਜ ਹੈ ਸਾਰਾ ਕੁਛ ਦਰਜ ਕੀਤਾ ਹੋਇਆ ਹੋਇਆ ਉੱਥੇ ਅਤੇ ਅਜਿਹੀਆਂ ਥਾਵਾਂ 'ਤੇ ਜਾਣ ਲਈ ਲੋਕਾਂ ਪਹਿਲਾਂ ਕਿਸੇ ਨੂੰ ਵੀ ਕੋਈ ਪਹੁੰਚ ਪ੍ਰਾਪਤ ਕਰਨ ਦੀ ਲੋੜ ਨਹੀਂ ਕੋਈ ਫੀਸ ਨਹੀਂ ਲੱਗਦੀ ਇੱਥੇ ਕੋਈ ਵੀ ਪੈਸਾ ਪ੍ਰਾਪਤ ਕੀਤਾ ਨਹੀਂ ਜਾ ਸਕਦਾ ਸਭ ਲਈ ਇਹ ਖੁੱਲ੍ਹੇ ਇਹ ਦਰਵਾਜ਼ੇ ਗੁਰਦੁਆਰੇ ਅਤੇ ਗੁਰੂ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿੰਦੇ ਹਨ ਹਮੇਸ਼ਾ ਹਰ ਇੱਕ ਲਈ ਖੁੱਲ੍ਹੇ ਹੁੰਦੇ ਹਨ ਇਹ ਦਰਵਾਜ਼ੇ ਸਵੇਰੇ ਨੌ ਵਜੇ ਤੋਂ ਲੈ ਕੇ ਸ਼ਾਮ ਪੰਜ ਵਜੇ ਤੱਕ ਅਜਾਇਬ ਘਰ ਖੁੱਲ੍ਹਾ ਹੁੰਦਾ ਹੈ ਇੱਥੇ ਕ ਹਰ ਕੋਈ ਜਾ ਕੇ ਜਦੋਂ ਵੀ ਕੋਈ ਮੱਥਾ ਟੇਕਣ ਜਾਂਦਾ ਹੈ ਗੁਰਦੁਆਰਾ ਸਾਹਿਬ ਵਿੱਚ ਇਹ ਗੁਰਦੁਆਰਾ ਬਹੁਤ ਹੀ ਮਸ਼ਹੂਰ ਹੈ ਆਪਣੇ ਇਤਿਹਾਸਿਕ ਸਥਾਨ ਲਈ ਇੱਥੇ ਸਭ ਨੂੰ ਸਭ ਨੂੰ ਇੱਥੇ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ ਇਹਦਾ ਇਤਿਹਾਸ ਪੜ੍ਹਨ ਜਾਂ ਸਭ ਨੂੰ ਹੁੰਦਾ ਹੈ ਇਤਿਹਾਸ ਜਾਨਣ ਦਾ ਇੱਥੇ ਕਿਸੇ ਕੋਲ ਕੋਈ ਫੀਸ ਨਹੀਂ ਲਿੱਤੀ ਜਾਂਦੀ ਇੱਥੇ ਘੁੰਮਣ ਲਈ ਹੋਰ ਵੀ ਬਹੁਤ ਸਾਰੇ ਸਥਾਨ ਹਨ ਲੋਕ ਆਪਣਾ ਸਮਾਂ ਬਿਤਾਉਣ ਲਈ ਅਕਸਰ ਗੁਰਦੁਆਰਾ ਸਾਹਿਬ ਸ਼ਾਮ ਸ਼ਾਮ ਦੇ ਸਮੇਂ ਲੋਕ ਘਰੋਂ ਬਾਹਰ ਨਿਕਲਦੇ ਹਨ ਗੁਰਦੁਆਰਾ ਸਾਹਿਬ ਆਪਣਾ ਟਾ ਸਮਾਂ ਬਿਤਾਉਂਦੇ ਹਨ ਮੰਦਰ ਜਾਂਦੇ ਹਨ ਚਰਚ ਜਾਂਦੇ ਹਨ ਜੋ ਇਸ ਕ੍ਰਿਸਚਨ ਹਨ ਉਹ ਚਰਚ ਜਾਂਦੇ ਹਨ ਲੋਕ ਮੰਦਰ ਜਾਂਦੇ ਹਨ ਹਿੰਦੂ ਧਰਮ ਦੇ ਲੋਕ ਇੱਥੇ ਕਿਸੇ ਧਰਮ ਦੇ ਇਹਨੂੰ ਕੋਈ ਬੰਦਿਸ਼ ਕੋਈ ਮਨਾਹੀ ਨਹੀਂ ਹੈ ਕਿ ਉਹ ਗੁਰਦੁਆਰੇ ਨਹੀਂ ਜਾ ਸਕਦਾ ਜਾਂ ਮੰਦਰ ਨਹੀਂ ਜਾ ਸਕਦਾ ਜਾਂ ਚਰਚ ਨਹੀਂ ਜਾ ਸਕਦਾ ਕਿਸੇ ਵੀ ਧਰਮ ਦਾ ਇਨਸਾਨ ਕਿਤੇ ਵੀ ਜਾ ਸਕਦਾ ਹੈ ਇਸ ਕਰਕੇ ਇੱਥੇ ਲੋਕ ਆਪਣਾ ਆਹ ਬਹੁਤ ਹੀ ਅੱਛਾ ਸਮਾਂ ਬਿਤਾਉਂਦੇ ਨੇ